ਹਾਂਜੀ ਉਹ ਨਾ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਕਰਨੀ ਸੀ ਅਤੇ ਮੇਰਾ ਜਿਹੜਾ ਬੈਂਕ ਦਾ ਸਰਵਰ ਹੈ ਉਹ ਥੋੜ੍ਹਾ ਡਾਊਨ ਹੋ ਚੁੱਕਿਆ ਅਤੇ ਉਹਦੇ ਕਰਕੇ ਜਿਹੜੀ ਔਨਲਾਈਨ ਪੇਮੈਂਟ ਹੈ ਉਹ ਮੇਰੇ ਕੋਲੋਂ ਹੋ ਨਹੀਂ ਰਹੀ ਹੈਗੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੀ ਮੈਂ ਤੁਹਾਨੂੰ ਨਕਦ ਜਿਹੜਾ ਭੁਗਤਾਨ ਹੈ ਉਹ ਕਰ ਸਕਦੀ ਹਾਂ ਤੁਸੀਂ ਮੇਰੇ ਤੋਂ ਕੈਸ਼ ਲੈ ਸਕਦੇ ਹੋ ਅਤੇ ਤੁਹਾਨੂੰ ਇਸ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਕਿਉਂਕਿ ਆਪਣੀ ਜਿਵੇਂ ਗੱਲ ਹੋਈ ਸੀ ਕਿ ਤੁਸੀਂ ਔਨਲਾਈਨ ਪੇਮੈਂਟ ਹੀ ਲੈਂਦੇ ਹੋ ਬਟ ਹੁਣ ਮੇਰਾ ਇੱਥੇ ਜਿਹੜਾ ਸਰਵਰ ਹੈ ਉਹ ਨਹੀਂ ਚੱਲ ਰਿਹਾ ਅਤੇ ਮੇਰੇ ਕੋਲ ਕੈਸ਼ ਹੈਗਾ ਆ ਤਾਂ ਤੁਸੀਂ ਕੈਸ਼ ਲੈ ਸਕਦੇ ਹੋ